ਮੈਂ ਕਈ ਮੁਕਾਬਲਿਆਂ ਵਿੱਚ ਹਿੱਸਾ ਦਿੱਤਾ ਹੈ ਪਰ ਮੇਰਾ ਇੱਕ ਸਕੂਲ ਟਾਈਮ ਦਾ ਮੁਕਾਬਲਾ ਬਹੁਤ ਵਧੀਆ ਰਿਹਾ ਜਿੱਥੋਂ ਜਿੱਥੇ ਮੈਂ ਜ਼ਿਲ੍ਹੇ ਲੈਵਲ 'ਤੇ ਖੇਡਣ ਗਈ ਸੀ ਇੱਥੇ ਮੈਂ ਨੇਚਰ ਦੀ ਪੇਂਟਿੰਗ ਬਣਾਈ ਸੀ ਅਤੇ ਮੈਂ ਕਲਰ ਵਗੈਰਾ ਬਹੁਤ ਵਧੀਆ ਕੀਤੇ ਸਨ ਅਤੇ ਜਦੋਂ ਮੈਂ ਜੱਜ ਜੱਜਾਂ ਨੂੰ ਦਿਖਾਉਣ ਗਈ ਤਾਂ ਉਹਨਾਂ ਨੇ ਬਹੁਤ ਮੇਰੀ ਤਾਰੀਫ ਕੀਤੀ ਅਤੇ ਉਹਨਾਂ ਨੇ ਮੈਨੂੰ ਫਸਟ ਪ੍ਰਾਈਜ਼ ਵੀ ਦਿੱਤਾ ਅਤੇ ਮੇਰੀ ਫੋਟੋ ਅਖਬਾਰ ਵਿੱਚ ਵੀ ਆਈ ਅਤੇ ਉਹਨਾਂ ਨੇ ਮੇਰੀ ਫੋਟੋ ਆਪਣੇ ਆਪਣੇ ਪਾਸਬੁੱਕ 'ਤੇ ਵੀ ਛਾਪੀ ਅਤੇ ਹੁਣ ਕਈ ਕਈ ਬੱਚੇ ਮੇਰੇ ਕੋਲ ਪੇਂਟਿੰਗ ਸਿੱਖਣ ਵੀ ਆਉਂਦੇ ਹਨ ਅਤੇ ਮੈਂ ਉਹਨਾਂ ਨੂੰ ਪੇਂਟਿੰਗ ਸਿਖਾਉਂਦੀ ਹਾਂ ਅਤੇ ਉਹ ਬਹੁਤ ਖੁਸ਼ ਹੁੰਦੇ ਹਨ ਅਤੇ ਮੇਰੇ ਪਰਿਵਾਰ ਵਗੈਰਾ ਵੀ ਬਹੁਤ ਖੁਸ਼ ਹੁੰਦੇ ਹਨ